ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਅਣਸੁਲਝੀਆਂ ਖੋਜਾਂ ਕਰਨੀਆਂ ਹਜੇ ਬਾਕੀ ਹਨ ਜਿਹਨਾਂ ਦੀ ਖੋਜ ਵਿੱਚ ਜਿੱਦਾਂ ਧ ਧਰਤੀ 'ਤੇ ਜੀਵਨ ਬਾਹਰ ਗ੍ਰਹਿਆਂ 'ਤੇ ਜੀਵਨ ਇਹੋ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਅਣਸੁਲਝੀਆਂ ਵੀ ਹਨ ਜਿਹਨਾਂ ਵਿੱਚ ਸੂਰਜ ਦੇ ਲੇਅਰਾਂ ਵੀ ਬਹੁਤ ਸਾਰੀਆਂ ਹਨ ਜਿਹਨਾਂ ਨੂੰ ਅਸੀਂ ਹਜੇ ਸੁਲਝਾ ਨਹੀਂ ਪਾਏ ਜਾਂ ਮੂਨ 'ਤੇ ਵੀ ਅਜੇ ਤੱਕ ਅਸੀਂ ਪਾਣੀ ਨਹੀਂ ਲੱਭ ਸਕੇ ਇੱਦਾਂ ਦੀਆਂ ਬਹੁਤ ਸਾਰੀਆਂ ਅਣਸੁ ਅਣਸੁਲਝੀਆ ਹੋਈਆ ਚੀਜ਼ਾਂ ਜੋ ਹਜੇ ਖੋਜ ਕਰਨ ਦੀ ਲੋੜ ਹੈ ਜਿੱਦਾਂ ਸਾਨੂੰ ਆਪਣੇ ਗ੍ਰਹਿਆਂ ਦੇ ਆਲੇ ਦੁਆਲੇ ਗ੍ਰਹਿਆਂ ਦੀ ਵੀ ਬਾਰੇ ਪਤਾ ਕਰਨ ਲਈ ਚੰਗੀ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ ਇਸ ਇੱਦਾਂ ਦੀਆਂ ਚੀਜ਼ਾਂ ਕਰਨ ਨਾਲ ਹੀ ਸਾਡੇ ਬ੍ਰਹਿਮੰਡ ਲਈ ਬਹੁਤ ਜ਼ਿਆਦਾ ਚੀਜ਼ਾਂ ਨੂੰ ਲੱਭਣਾ ਸਿੱਖਣਾ ਅਤੇ ਲੱਭਣਾ ਚਾਹੀਦਾ ਹੈ